ਟੈਕਨੌਲੋਜੀ ਨੇ ਫੋਟੋਗ੍ਰਾਫੀ ਦੇ ਖੇਤਰ ਨੂੰ ਗਹਿਰਾ ਪ੍ਰਭਾਵਿਤ ਕੀਤਾ ਹੈ ਪਹਿਲਾਂ ਜਿੱਥੇ ਫੋਟੋ ਖਿੱਚਣ ਲਈ ਫ਼ਿਲਮ ਅਤੇ ਕੈਮਰੇ ਦੀ ਲੋੜ ਸੀ ਹੁਣ ਡਿਜੀਟਲ ਕੈਮਰੇ ਅਤੇ ਸਮਾਰਟ ਫੋਨ ਦੁਆਰਾ ਲੋਕ ਆਸਾਨੀ ਨਾਲ ਅਤੇ ਤੇਜ਼ੀ ਨਾਲ ਫੋਟੋ ਖਿੱਚ ਸਕਦੇ ਹਨ ਇਸ ਨਾਲ ਫੋਟੋਗ੍ਰਾਫੀ ਦੀ ਅਦਲਾ ਬਦਲੀ ਵੀ ਆਈ ਹੈ ਜਿਵੇਂ ਕਿ ਇੰਸਟੈਂਟ ਫੋਟੋਆਂ ਐਡੀਟਿੰਗ ਐਪਲੀਕਸ਼ਨਾਂ ਅਤੇ ਸੋਸ਼ਲ ਮੀਡੀਆ ਦੀ ਵਧੀਆ ਵਰਤੋਂ ਜਿਸ ਨਾਲ ਲੋਕ ਆਪਣੀ ਫੋਟੋਗ੍ਰਾਫੀ ਨੂੰ ਹਮੇਸ਼ਾ ਸਾਂਝਾ ਕਰ ਸਕਦੇ ਹਨ ਨਵੀਂ ਟੈਕਨੌਲੋਜੀ ਨਾਲ ਸਿਰਫ਼ ਫੋਟੋ ਖਿੱਚਣਾ ਨਹੀਂ ਸਗੋਂ ਉਨ੍ਹਾਂ ਦੀ ਸੰਪਾਦਨਾ ਅਤੇ ਸਾਂਝੇਦਾਰੀ ਵੀ ਕਾਫ਼ੀ ਆਸਾਨ ਹੋ ਗਈ ਹੈ ਇਹ ਫੋਟੋਗ੍ਰਾਫੀ ਨੂੰ ਹਰ ਕਿਸੇ ਲਈ ਕ੍ਰਿਆਸ਼ੀਲ ਅਤੇ ਸਹੂਲਤਦਾਇਕ ਬਣਾ ਦਿੰਦੀ ਹੈ